ਖੇਡਾਂ ਮਨੁੱਖ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜੇਕਰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਤਾਂ ਸਮੇਂ ਦੇ ਬਦਲਣ ਦੇ ਨਾਲ ਬਜ਼ੁਰਗਾਂ ਦੀਆਂ ਖੇਡਾਂ ਵਿੱਚ ਕੋਈ ਖ਼ਾਸ ਬਦਲਾਵ ਨਹੀਂ ਆਇਆ ਹੈ ਮੌਜੂਦਾ ਸਮੇਂ ਵਿੱਚ ਵੀ ਬਜ਼ੁਰਗ ਪੁਰਾਣੀਆਂ ਖੇਡਾਂ ਹੀ ਖੇਡਦੇ ਹਨ ਕਿਉਂਕਿ ਉਹ ਟੈਕਨੋਲੋਜੀ ਨਾਲ ਕੋਈ ਜ਼ਿਆਦਾ ਲਗਾਵ ਨਹੀਂ ਰੱਖਦੇ ਹਨ ਉਹਨਾਂ ਵੱਲੋਂ ਪੁਰਾਣੀਆਂ ਖੇਡਾਂ ਜਿਵੇਂ ਕਿ ਤਾਸ਼ ਆਦਿ ਖੇਡੀ ਜਾਂਦੀ ਹੈ ਇਹ ਖੇਡ ਆਮ ਤੌਰ 'ਤੇ ਪਿੰਡ ਦੀਆਂ ਸੱਥਾਂ ਵਿੱਚ ਬੈਠ ਕੇ ਬਜ਼ੁਰਗਾਂ ਦੁਆਰਾ ਖੇਡੀ ਜਾਂਦੀ ਹੈ ਇਸ ਵਿੱਚ ਪੱਤੇ 'ਤੇ ਪੱਤਾ ਸੀਪ ਆਦਿ ਮੁੱਖ ਤੌਰ 'ਤੇ ਸ਼ਾਮਿਲ ਹੈ ਇਸ ਤੋਂ ਇਲਾਵਾ ਸਾਡੇ ਪਿੰਡ ਵਿੱਚ ਬਜ਼ੁਰਗਾਂ ਲਈ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵੱਲੋਂ ਇੱਕ ਸੈਰਗਾਹ ਵੀ ਬਣਾਈ ਗਈ ਹੈ ਪਿੰਡ ਵਿੱਚ ਸ਼ਾਮ ਦੇ ਸਮੇਂ ਬਜ਼ੁਰਗ ਉੱਥੇ ਸੈਰ ਕਰਦੇ ਹਨ ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਬਜ਼ੁਰਗਾਂ ਵੱਲੋਂ ਇਹ ਕਬੱਡੀ ਦੀ ਅਤੇ ਦਾਅ ਪੇਚ ਨਵੇਂ ਨੌਜਵਾਨਾਂ ਨੂੰ ਸਿਖਾਉਣ ਦੇ ਨਾਲ ਨਾਲ ਕਈ ਟੂਰਨਾਮੈਂਟਾਂ ਵਿੱਚ ਬਜ਼ੁਰਗਾਂ ਦੇ ਕਬੱਡੀ ਦੇ ਮੈਚ ਆਦਿ ਕਬੱਡੀ ਅਤੇ ਵਾਲੀਬਾਲ ਦੇ ਮੈਚ ਆਦਿ ਵੀ ਹੁੰਦੇ ਹਨ ਸਾਡੇ ਪਿੰਡ ਵਿੱਚ ਮਾਘੀ ਦੇ ਮੇਲੇ ਦੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਇੱਕ ਹਲਟ ਦੌੜਾਂ ਅ ਦਾ ਮੇਲਾ ਲੱਗਦਾ ਹੈ ਇਸ ਵਿੱਚ ਬਲਦਾਂ ਅਤੇ ਝੋਟਿਆਂ ਦੀਆਂ ਹਲਟ ਦੌੜਾਂ ਕਰਵਾਈਆਂ ਜਾਂਦੀਆਂ ਹਨ ਬਜ਼ੁਰਗਾਂ ਵੱਲੋਂ ਏ ਬਲਦਾਂ ਨੂੰ ਉੱਥੇ ਭਜਾਇਆ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਹਫ਼ਤੇ ਵਿੱਚ ਕਈ ਵਾਰ ਉਹਨਾਂ ਨੂੰ ਇਹ ਪ੍ਰੈਕਟਿਸ ਵੀ ਕਰਵਾਈ ਜਾਂਦੀ ਹੈ ਇਸ ਕਰਕੇ ਬਜ਼ੁਰਗਾਂ ਵੱਲੋਂ ਬਜ਼ੁਰਗਾਂ ਦਾ ਹਲਟ ਦੌੜਾਂ ਨਾਲ ਵੀ ਖ਼ਾਸ ਲਗਾਵ ਹੈ